ਮੈਂ ਤੁਹਾਡੇ ਨਾਲ ਬਹੁਤ ਹੀ ਇੱਕ ਮਜੇਦਾਰ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਗੱਲ ਦੋ ਹਜ਼ਾਰ ਛੇ ਦੀ ਹੈ ਜਦੋਂ ਮੈਂ ਦਸਵੀਂ ਦੇ ਵਿੱਚ ਪੜ੍ਹਦਾ ਸੀ ਤਾਂ ਉਸ ਸਮੇਂ ਕਲਾਸ ਦੇ ਵਿੱਚ ਅਸੀਂ ਬੈਠੇ ਸੀਗੇ ਕਲਾਸ ਲੱਗੀ ਹੋਈ ਸੀ ਅਤੇ ਸਾਡਾ ਐੱਸ ਐੱਸ ਦਾ ਪੀਰਡ ਸੀਗਾ ਜਿਹਦੇ ਵਿੱਚ ਸਾਡੇ ਮੈਡਮ ਪਰਮਜੀਤ ਕੌਰ ਜੀ ਸਾਨੂੰ ਪੜ੍ਹਾ ਰਹੇ ਸੀ ਅਤੇ ਉਸ ਉਸਦੇ ਵਿੱਚ ਕੁਝ ਬੱਚੇ ਸ਼ਰਾਰਤ ਕਰ ਰਹੇ ਸੀ ਅਤੇ ਉਹਨਾਂ ਬੱਚਿਆਂ ਦੇ ਵਿੱਚ ਮੇਰਾ ਇੱਕ ਬੈਸਟ ਫਰੈਂਡ ਸੀ ਅਤੇ ਉਹ ਬੱਚਾ ਉਹ ਬੱਚਾ ਮੈਡਮ ਕੋਲ ਸੇਖੀ ਮਾਰ ਰਿਹਾ ਸੀ ਅਖੇ ਵੀ ਅਸੀਂ ਸਮੋਸੇ ਲੈਣ ਜਾਣਾ ਹੈ ਅਤੇ ਉਹ ਦੁਕਾਨ ਦਾ ਨਾਮ ਬੋਲ ਰਿਹਾ ਸੀ ਅਸੀਂ ਲੱਕੀ ਸਮੋਸੇ ਵਾਲਿਆਂ ਕੋਲੋਂ ਸਮੋਸੇ ਲੈ ਕੇ ਆਉਣੇ ਹਨ ਤਾਂ ਮੈਮ ਥੋੜ੍ਹਾ ਹੈਰਾਨ ਹੋ ਗਏ ਵੀ ਲੱਕੀ ਸਮੋਸੇ ਵਾਲਾ ਤੁਹਾਨੂੰ ਜਾਣਦਾ ਹੈ ਤੁਹਾਡਾ ਕੋਈ ਰਿਸ਼ਤੇਦਾਰ ਹੈ ਤਾਂ ਉਸ 'ਤੇ ਮੈਂ ਕਿਹਾ ਮੈਡਮ ਇਹ ਸਕੂਲ ਟਾਈਮ ਤੋਂ ਬਾਅਦ ਉੱਥੇ ਜਾ ਕੇ ਭਾਂਡੇ ਵਗੈਰਾ ਮਾਂਜਦਾ ਹੈ ਤਾਂ ਇਹ ਗੱਲ ਸੁਣ ਕੇ ਸਾਡੇ ਸਾਰੇ ਕਲਾਸ ਦੇ ਵਿੱਚ ਹਾਸਾ ਠਾਠਾ ਹੋ ਗਿਆ ਸ਼ੁਰੂ ਹੋ ਗਿਆ ਜਿਹਦੇ ਵਿੱਚ ਮੈਮ ਵੀ ਹੱਸਣ ਲੱਗ ਗਏ ਅਤੇ ਜਿਹੜਾ ਉਹ ਮੇਰਾ ਫ ਫਰੈਂਡ ਸੀਗਾ ਉਹ ਸ਼ਰਮਿੰਦਾ ਹੋ ਕੇ ਨੀਵੀਂ ਪਾ ਕੇ ਬੈਠ ਗਿਆ ਅਤੇ ਇਹ ਗੱਲ ਮੇਰੇ ਜਦੋਂ ਵੀ ਚੇਤੇ ਆਉਂਦੀ ਹੈ ਤਾਂ ਮੈਂ ਬਹੁਤ ਹੱਸਦਾ ਹਾਂ ਤੇ ਮੇਰੇ ਜਿਹੜਾ ਦਿਮਾਗ ਫਰੈਸ਼ ਹੋ ਜਾਂਦਾ ਹੈ ਅਤੇ ਇਹ ਗੱਲ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਅਸਹਿਜੇ ਤੌਰ 'ਤੇ ਜੁੜੀ ਹੋਈ ਹੈ ਜਿੱਥੇ ਵੀ ਮੈਂ ਬੈਠਦਾ ਹਾਂ ਤਾਂ ਇਹ ਗੱਲ ਇਹ ਚੁਟਕਲਾ ਐਜ ਏ ਚੁਟਕਲਾ ਮੈਂ ਸ਼ੇਅਰ ਕਰਦਾ ਹਾਂ